ਜਲੰਧਰ ਤੋਂ ਅਸੀਂ ਦਰਬਾਰ ਸਾਹਿਬ ਜਾਣ ਵਾਸਤੇ ਮੋਟਰਸਾਈਕਲ 'ਤੇ ਗਏ ਦੋਸਤਾਂ ਦੇ ਨਾਲ ਗਏ ਜਿਸ ਵਿੱਚ ਸਟਾਟਿੰਗ ਵਿੱਚ ਦਰਬਾਰ ਸਾਹਿਬ ਗਏ ਅਤੇ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਫਿਰ ਉਸ ਤੋਂ ਬਾਅਦ ਅਸੀਂ ਮੋਟਰਸਾਈਕਲ 'ਤੇ ਵਾਹਗਾ ਬੋਡਰ ਗਏ ਉੱਥੇ ਅਸੀਂ ਜੋ ਕਿ ਸੈਂਟਰ ਗੌਮੈਂਟ ਦੀ ਝੰਡੇ ਦੀ ਰਸਮ ਦੇਖੀ ਦੇਖ ਕੇ ਜਦੋਂ ਅਸੀਂ ਵਾਪਿਸ ਆਏ ਤਾਂ ਵਾਪਿਸ ਆਉਂਦਿਆਂ ਰਸਤੇ ਦੇ ਵਿੱਚ ਹਵੇਲੀ ਤੋਂ ਚਾਹ ਪੀਤੀ ਚਾਹ ਪੀ ਕੇ ਉਸ ਉੱਥੋਂ ਵੀ ਅਸੀਂ ਬਾਈਕ 'ਤੇ ਚੱਲੇ ਅਤੇ ਬਾਈਕ 'ਤੇ ਵਾਪਿਸ ਆਉਂਦੇ ਆਉਂਦੇ ਸਾਡੀ ਰਸਤੇ ਵਿੱਚ ਬਾਈਕ ਖਰਾਬ ਹੋ ਗਈ ਜਿਸ ਦੇ ਨਾਲ ਸਾਡੇ ਹੁੰ ਕੋਈ ਮਕੈਨਿਕ ਨਹੀਂ ਮਿਲਿਆ ਅਤੇ ਬਾਰਿਸ਼ ਹੋਣ ਦੇ ਕਾਰਨ ਅਸੀਂ ਬਹੁਤ ਔਖੇ ਵਾਪਿਸ ਆਏ